ਹੈਲੋ ਹਾਂਜੀ ਸਰ ਗਿੱਲ ਏਜੰਸੀ ਤੋਂ ਬੋਲਦੇ ਜੇ ਸਰ ਮੈਂ ਜਗਜੀਤ ਸਿੰਘ ਪਿੰਡ ਘਸੀਟਪੁਰ ਤੋਂ ਬੋਲਦਾ ਜੀ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਡਾ ਕੋਈ ਪੰਦਰਾਂ ਮਈ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਜਾਣ ਵਾਸਤੇ ਆਪਣੇ ਫੈਮਲੀ ਦੇ ਸੱਤ ਜੀਅ ਚੰਡੀਗੜ੍ਹ ਜਾਣਾ ਜੇ ਅਤੇ ਕੋਈ ਸੱਤ ਵਜੇ ਨੂੰ ਕੈਬ ਸਾਡੇ ਕੋਲ ਹਾਜ਼ਰ ਚਾਹੀਦੀ ਹੈ ਹਾਂਜੀ ਕੋਈ ਵਧੀਆ ਡਰਾਈਵਰ ਹੋਵੇ ਜੋ ਗੱਡੀ ਜ਼ਿਆਦਾ ਤੇਜ਼ ਨਾ ਚਲਾਵੇ ਅਤੇ ਸਾਨੂੰ ਟਾਈਮ ਨਾਲ ਬਾਰਾਂ ਕੁ ਵਜੇ ਤੱਕ ਚੰਡੀਗੜ੍ਹ ਪਹੁੰਚਾ ਦੇ ਉੱਧਰੋਂ ਵਾਪਸੀ ਆਉਣ ਦਾ ਸਮਾਂ ਸਾਡਾ ਚਾਰ ਵਜੇ ਦਾ ਹੋਵੇਗਾ ਹਾਂਜੀ ਆਪਾਂ ਪ੍ਰੋਗਰਾਮ ਅਟੈਂਡ ਕਰਕੇ ਅਸੀਂ ਸ਼ਾਮ ਨੂੰ ਚਾਰ ਵਜੇ ਵਾਪਸੀ ਤੁਰਨਾ ਹੈ ਅਤੇ ਜੋ ਵੀ ਤੁਹਾਡਾ ਚਾਰਜ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਗੱਡੀ ਵਧੀਆ ਹੋਵੇ ਸਾਫ਼ ਸੁਥਰੀ ਗੱਡੀ ਹੋਵੇ ਅਤੇ ਸਾਨੂੰ ਜਿਹਦੇ ਵਿੱਚ ਜਾਣ ਵਿੱਚ ਕੋਈ ਦਿੱਕਤ ਨਾ ਹੋਵੇ ਠੀਕ ਹੈ ਸਰ ਮਿਹਰਬਾਨੀ ਜੀ